ਭਾਰਤ ਵਿੱਚ ਸਭ ਤੋਂ ਜਿਹੜੀਆਂ ਪ੍ਰਸਿੱਧ ਖੇਡਾਂ ਨੇ ਉਹਨਾਂ ਦੇ ਵਿੱਚ ਆਉਂਦੀਆਂ ਕ੍ਰਿਕਟ ਕਬੱਡੀ ਹਾਕੀ ਵੋਲੀਬਾਲ ਫੁੱਟਬਾਲ ਜੇ ਇਸ ਤੋਂ ਇਲਾਵਾ ਗੱਲ ਕਰੀਏ ਤਾਂ ਉਹਦੇ ਵਿੱਚ ਆਉਂਦੀ ਆ ਕੁਸ਼ਤੀ ਬੈਡਮਿੰਟਨ ਟੈਨਿਸ ਜੂਡੋ ਕਰਾਟੇ ਖੋ ਖੋ ਆਦਿ ਵੀ ਬਹੁਤ ਜ਼ਿਆਦਾ ਪ੍ਰਚਲਿਤ ਨੇ ਜੇ ਅਸੀਂ ਗੱਲ ਕਰੀਏ ਇਸ ਸਮੇਂ ਸਭ ਤੋਂ ਜ਼ਿਆਦਾ ਜਿਹੜੀ ਕ੍ਰਿਕਟ ਦੇ ਵਿੱਚ ਖੇਡੀ ਜਾ ਰਹੀ ਆ ਉਹ ਟੀ ਟਵੈਂਟੀ ਆ ਬਹੁਤ ਜ਼ਿਆਦਾ ਦੇਖੀ ਜਾਂਦੀ ਆ ਸਭ ਲੋਕਾਂ ਦੀ ਜਿਹੜੀ ਹੈ ਹਰਮਨ ਪਿਆਰੀ ਖੇਡ ਬਣ ਚੁੱਕੀ ਹੈਗੀ ਅਤੇ ਜੇ ਸਾਡੇ ਅਸੀਂ ਐਥਲੀਟਾਂ ਦੀ ਗੱਲ ਕਰੀਏ ਸਭ ਤੋਂ ਮਸ਼ਹੂਰ ਐਥਲੀਟਾਂ ਦੇ ਵਿੱਚ ਸਾਡੇ ਕੋਲ ਪੀ ਟੀ ਊਸ਼ਾ ਮਿਲਖਾ ਸਿੰਘ ਜੋ ਕਿ ਹੁਣ ਨਹੀਂ ਰਹੇ ਪਰ ਉਹ ਸਾਡੇ ਬਹੁਤ ਹੀ ਮਸ਼ਹੂਰ ਐਥਲੀਟ ਰਹੇ ਨੇ ਵਿਰਾਟ ਕੋਹਲੀ ਨੀਰਜ ਚੋਪੜਾ ਸਚਿਨ ਤੇਂਦੁਲਕਰ ਵੀ ਮਸ਼ਹੂਰ ਅਥਲੀਟ ਰਹਿ ਚੁੱਕੇ ਨੇਗੇ ਉਹ ਆਉਂਦੇ ਨੇ ਪੀ ਟੀ ਊਸ਼ਾ ਨੇ ਜਿਹੜੇ ਇੱਕ ਆਮ ਜਿਹੇ ਪਰਿਵਾਰ ਤੋਂ ਸੰਬੰਧਿਤ ਨੇ ਅਤੇ ਉਹਨਾਂ ਦੇ ਕੋਲ ਬਹੁਤ ਜ਼ਿਆਦਾ ਸਹੂਲਤਾਂ ਵੀ ਨਹੀਂ ਸੀਗੀਆਂ ਇਹਨਾਂ ਕਮੀਆਂ ਦੇ ਬਾਵਜੂਦ ਵੀ ਉਹ ਆਪਣੀ ਮਿਹਨਤ ਦੇ ਨਾਲ ਇੱਥੋਂ ਤੱਕ ਪਹੁੰਚੇ ਨੇਗੇ ਜੇ ਅਸੀਂ ਵਿਰਾਟ ਕੋਹਲੀ ਦੀ ਗੱਲ ਕਰੀਏ ਤਾਂ ਉਸ ਸਮੇਂ ਪਸੰਦੀਦੇ ਕ੍ਰਿਕਟਰ ਨੇਗੇ ਅਤੇ ਆਪਣੀ ਮਿਹਨਤ ਦੇ ਨਾਲ ਉਹ ਇੱਥੋਂ ਤੱਕ ਪਹੁੰਚੇ